ਮੋਹਾਲੀ ਜ਼ਿਲ੍ਹੇ ਵਿੱਚ ਵੈਸੇ ਤਾਂ ਬਹੁਤ ਸਾਰੀਆਂ ਕਮੀਆਂ ਹਨ ਅਤੇ ਜਿਹੜੀਆਂ ਕਮੀਆਂ ਮੈਨੂੰ ਲੱਗਦੀਆਂ ਹਨ ਉਹ ਹਨ ਸਿੱਖਿਆ ਸਿੱਖਿਆ ਜਿਹੜਾ ਪੱਧਰ ਆ ਉੱਚਾ ਚੁੱਕਣਾ ਚਾਹੀਦਾ ਹੈ ਅਤੇ ਸਿਹਤ ਸਿਹਤ ਦੀ ਜਿਵੇਂ ਹੋਸ ਹਸਪਤਾਲ ਹੋ ਗਏ ਉਹਨਾਂ ਦੇ ਵਿੱਚ ਡੋਕਟਰ ਹੋਣੇ ਚਾਹੀਦੇ ਨੇ ਅਤੇ ਦਵਾਈਆਂ ਜਿਹੜੀਆਂ ਉਹ ਵਧੀਆ ਪ੍ਰੋਵਾਈਡ ਹੋਣੀਆਂ ਚਾਹੀਦੀਆਂ ਹਨ ਅਤੇ ਗਰੀਬੀ ਨੂੰ ਘਟਾਉਣ ਲਈ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ਅਤੇ ਹੋਰ ਜਿਵੇਂ ਔਰਤਾਂ ਔਰਤਾਂ ਬਾਰੇ ਸੋਚਣਾ ਚਾਹੀਦਾ ਔਰਤਾਂ ਜਿਵੇਂ ਪੈਨਸ਼ਨ ਵਗੈਰਾ ਹੋ ਗਈ ਜਿਵੇਂ ਵਿਧਵਾ ਹੋ ਗਈਆਂ ਉਹਨਾਂ ਲਈ ਕਰਨਾ ਚਾਹੀਦਾ ਕੁਛ ਹੋਰ